ਹੈਲੋ ਹਾਂਜੀ ਰਾਜ ਕੁਮਾਰ ਜੀ ਬੋਲਦੇ ਹੋ ਜੀ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੈਂ ਪੁੱਛਣਾ ਸੀਗਾ ਕਿ ਉਰੇ ਸਬਜ਼ੀਆਂ ਸੁਬਜ਼ੀਆਂ ਵਾਲਾ ਦੁਕਾਨ ਦਕੂਨ ਕਿਹੜੀ ਵਧੀਆ ਯਾਰ ਮੈਨੂੰ ਨਾ ਇੱਥੋਂ ਮੈਂ ਇੱਥੋਂ ਲੈ ਕੇ ਆਇਆ ਸੀ ਭੋਲੇ ਕੋਲੋਂ ਸਬਜ਼ੀ ਲੈ ਕੇ ਆਇਆ ਸੀ ਸਬਜ਼ੀ ਨਹੀਂ ਬਣੀ ਹੈਗੀ ਬਸ ਕਿਆ ਬੋਲਾਂ ਮੈਂ ਹੁਣ ਤਾਂ ਕਰਕੇ ਮੈਨੂੰ ਕੋਈ ਵੀ ਸਬਜ਼ੀ ਹੋਵੇ ਜਿੱਦਾਂ ਆਮ ਨੋਰਮਲ ਸਭ ਮਿਲਦੀਆਂ ਹੀ ਹੈ ਹਾਂਜੀ ਕੋਈ ਵੀ ਤੁਸੀਂ ਮੈਨੂੰ ਦੱਸ ਦਿਉ ਕੋਈ ਵਧੀਆ ਦੁਕਾਨ ਹੈ ਜਿੱਥੇ ਤੁਸੀਂ ਸਬਜ਼ੀ ਲੈਂਦੇ ਹੋ ਮੈਨੂੰ ਦੱਸ ਦਿਉ ਮੈਂ ਵੀ ਲੈ ਲਿਆ ਕਰਾਂਗਾਂ ਉੱਥੋਂ ਹਾਂਜੀ ਹਾਂਜੀ ਓਕੇ ਓਕੇ ਨਹੀਂ ਮੈਨੂੰ ਕੋਈ ਦਿੱਕਤ ਪ੍ਰੇਸ਼ਾਨੀ ਹੋਈ ਮੈਂ ਕੋਲ ਕਰ ਲੂੰਗਾ ਸਬਜ਼ੀ ਬੈਸਟ ਹੈ ਉੱਥੇ ਦੀ ਮਤਲਬ ਕੋਈ ਐਂ ਨਾ ਹੋਵੇ ਕਿਤੇ ਸਬਜ਼ੀ ਆਪਾਂ ਕਿਤੇ ਘਰ ਆ ਕੇ ਚੀਰੀਏ ਅਤੇ ਉਹਦੇ ਵਿੱਚੋਂ ਕੀੜਾ ਕੂੜਾ ਲੱਗਿਆ ਮਿਲ ਜਾਵੇ ਓਕੇ ਓਕੇ ਜੀ ਸਬਜ਼ੀ ਫ੍ਰੈਸ਼ ਹੈ ਉਹਨਾਂ ਦੀ ਓਕੇ ਥੈਂਕ ਯੂ